ਸਾਡੇ ਸੱਭਿਆਚਾਰ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਸਾਡੇ ਦੇਸ਼ ਵਿੱਚ ਕਣਕ ਜੀਰੀ ਕਪਾਹ ਸਰ੍ਹੋਂ ਦੀ ਖੇਤੀ ਕੀਤੀ ਜਾਂਦੀ ਹੈ ਇਸ ਖੇਤੀਬਾੜੀ ਨਾਲ ਸਾਡੇ ਲੋਕਾਂ ਦਾ ਬਹੁਤ ਪਿਆਰ ਹੈ ਉਹ ਹਰ ਸੋਹਣੀ ਹਾੜੀ ਖੇਤੀ ਕਰਦੇ ਹਨ ਅਤੇ ਆਪਣੀ ਫਸਲ ਉਗਾਉਂਦੇ ਹਨ ਕਣਕ ਦੀ ਫਸਲ ਕੱਤਕ ਦੇ ਮਹੀਨੇ ਵਿੱਚ ਉਗਾਈ ਜਾਂਦੀ ਹੈ ਅਤੇ ਵਿਸਾਖ ਦੇ ਮਹੀਨੇ ਵਿੱਚ ਕਟਾਈ ਕੀਤੀ ਜਾਂਦੀ ਹੈ ਇਸ ਦਿਨ ਕਿਸਾਨ ਖੁਸ਼ੀ ਨਾਲ ਭੰਗੜੇ ਪਾਉਂਦੇ ਹਨ ਅਤੇ ਢੋਲ ਵਜਾਉਂਦੇ ਹਨ ਇਸ ਨਾਲ ਉਹ ਆਪਣੀ ਖੁਸ਼ੀ ਦਾ ਜ਼ਾਹਿਰ ਕਰਦੇ ਹਨ ਜੀਰੀ ਜੇਠ ਦੇ ਮਹੀਨੇ ਵਿੱਚ ਲਾਈ ਜਾਂਦੀ ਹੈ ਅਤੇ ਕੱਤਕ ਦੇ ਮਹੀਨੇ ਵਿੱਚ ਵੱਢੀ ਜਾਂਦੀ ਹੈ ਲੋਕ ਇਸ ਕਿੱਤੇ ਨਾਲ ਬਹੁਤ ਜੁੜੇ ਹੋਏ ਹਨ ਇਹ ਕਿੱਤਾ ਸਾਡੇ ਜੱਟਾਂ ਦਾ ਇਹੀ ਕਿੱਤਾ ਸਾਡੇ ਜੱਟਾਂ ਦਾ ਮੁੱਖ ਹੈ ਖੇਤੀਬਾੜੀ ਕਿੱਤੇ ਤੋਂ ਹੀ ਸਾਰੇ ਦੇਸ਼ ਨੂੰ ਅੰਨ ਪ੍ਰਾਪਤ ਹੁੰਦਾ ਹੈ ਸਾਡੇ ਪੁਰਾਣੇ ਵੱਡੇ ਵਡੇਰੇ ਖੇਤੀਬਾੜੀ ਹੀ ਕਰਦੇ ਹਨ ਪਰ ਨਵੀਂ ਪੀੜ੍ਹੀ ਅੱਜ ਕੱਲ੍ਹ ਪੜ੍ਹਾਈ ਕਰਕੇ ਬਾਹਰ ਜਾਣ ਵਿੱਚ ਹੀ ਰੁਚੀ ਰੱਖਦੀ ਹੈ ਖੇਤੀਬਾੜੀ ਤੋਂ ਦੂਰ ਹੀ ਜਾਈ ਜਾਂਦੇ ਹਨ ਕਿਉਂਕਿ ਉਹਨਾਂ ਦਾ ਰੁਝਾਨ ਹੁਣ ਬਾਹਰ ਵੱਲ ਹੈ ਉਹ ਬਾਹਰ ਜਾ ਕੇ ਆਪਣੀ ਕਮਾਈ ਕਰਨਾ ਚਾਹੁੰਦੇ ਹਨ